ਮੈਂ ਅੰਗਰੇਜ਼ ਸਿੰਘ ਵਿਚਾਰ ਕਰਦਾ ਹਾਂ ਆਪਣੇ ਪਿੰਡਾਂ ਦੇ ਲੋਕਾਂ ਨਾਚ ਰੂਪਾਂ ਨੂੰ ਸੁਰੱਖਿਤ ਰੱਖਣਾ ਅਤੇ ਸਧਾਰਨ ਕਰਨ ਲਈ ਉਨੀ ਸੌ ਸੰਤਾਲੀ ਈਸਵੀ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ਾਂ ਦੀ ਵੰਡ ਵੰਡ ਹੋ ਗਈ ਸੀ ਇਸ ਵੰਡ ਦੌਰਾਨ ਪੰਜਾਬ ਪੰਜਾਬ ਦੇ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਵੰਡ ਅਨੁਸਾਰ ਭਾਰਤ ਵਿੱਚ ਚੜ੍ਹਦਾ ਪੰਜਾਬ ਅਤੇ ਪਾਕਿਸਤਾਨ ਵਿੱਚ ਲਹਿੰਦਾ ਪੰਜਾਬ ਰਹਿ ਗਿਆ ਸੀ ਪੰਜਾਬ ਦੀ ਜ਼ਿਆਦਾ ਖੇਤਰਾਂ ਪੰਜਾਬ ਦੀ ਜ਼ਿਆਦਾਤਰ ਖੇਤਰਾਂ ਪਾਕਿਸਤਾਨ ਵਿੱਚ ਚਲਾਇਆ ਗਿਆ ਸੀ ਅਤੇ ਪੰਜਾਬ ਦਾ ਜ਼ਿਆਦਾ ਸੱਭਿਆਚਾਰ ਪਾਕਿਸਤਾਨ ਵਾਲੇ ਪਾਸੇ ਰਹਿ ਗਿਆ ਸੀ ਪਹਿਲਾਂ ਪਹਿਲਾਂ ਸਮੱਸਿਆ ਵਿੱਚ ਪੰਜਾਬੀ ਪਹਿਲਾਂ ਸਮੇਂ ਵਿੱਚ ਪੰਜਾਬੀ ਸੱਭਿਆਚਾਰ ਪਰਿਵਾਰਿਕ ਮੈਂਬਰ ਇਕੱਠੇ ਬੈਠ ਕੇ ਸੁਣਦੇ ਸੁਣਦੇ ਸੀ ਆਨੰਦ ਮਾਣਦੇ ਸੀ ਪਰ ਅੱਜ ਦੇ ਸਮੇਂ ਵਿੱਚ ਪੰਜਾਬੀ ਗਾਇਕ ਜ਼ਿਆਦਾਤਰ ਪੰਜਾਬੀ ਸੱਭਿਆਚਾਰ ਦਾ ਘਾਣ ਕਰ ਰਹੇ ਹਨ ਜਿਵੇਂ ਅੱਜ ਦੇ ਗੀਤ ਬਹੁਤ ਸਮਾਜ ਦੇ ਘਾਣ ਕਰ ਰਹੇ ਨੇ ਇਹਨਾਂ ਨੂੰ ਸੁਧਾਰਨਾ ਚਾਹੀਦਾ ਕਿਉਂਕਿ ਆਪਣੇ ਪੜ੍ਹੇ ਲਿਖੇ ਪੰਜਾਬੀ ਨੌਜਵਾਨ ਆਪਣੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਪਹੁੰਚ ਕੇ ਵਿਦੇਸ਼ਾਂ ਵਿੱਚ ਜਾ ਕੇ ਜੋ ਕਿ ਆਪਣਾ ਰੰਗ ਢੰਗ ਦਿਖਾਉਂਦੇ ਨੇ ਜੋ ਕਿ ਇਹਨਾਂ ਵਿੱਚ ਤਾਂ ਬਹੁਤ ਸੁਧਾਰ ਕਰਨਾ ਚਾਹੀਦਾ ਜੋ ਕਿ ਆਪਣੇ ਪਿਛਲੇ ਜ਼ਮਾਨੇ ਵਿੱਚ ਕਿਉਂਕਿ ਆਪਣਾ ਸੱਭਿਆਚਾਰ ਹੁੰਦਾ ਸੀਗਾ ਉਹ ਸਾਰੇ ਜਣੇ ਇਕੱਠੇ ਬੈਠ ਕੇ ਜਾਂ ਆਪਣੇ ਪਰਿਵਾਰ ਵਿੱਚ ਬੈਠ ਕੇ ਆਨੰਦ ਮਾਣਦੇ ਸੀ ਆਪਣੇ ਖੁਸ਼ੀ ਮਨਾਉਂਦੇ ਸੀ ਕਿਉਂਕਿ ਅੱਜ ਦੇ ਸੱਭਿਆਚਾਰ ਨੂੰ ਜੇ ਆਪਾਂ ਸੋਚੀਏ ਤਾਂ ਬਹੁਤ ਘਾਣ ਹੋ ਰਿਹਾ ਇਸ ਨੂੰ ਸੁਧਾਰ ਕਰਨਾ ਚਾਹੀਦਾ ਹੈ